ਭੰਗੜਾ ਸਾਡੇ ਪੰਜਾਬ ਦਾ ਲੋਕ ਨਾਚ ਹੈ ਭੰਗੜਾ ਖੁਸ਼ੀ ਦੇ ਮੌਕੇ 'ਤੇ ਪਾਇਆ ਜਾਂਦਾ ਹੈ ਭੰਗੜਾ ਪੰਜਾਬ ਦੇ ਦੋ ਮੁੱਖ ਭਾਗ ਅਤੇ ਉੱਘੇ ਲੋਕ ਨਾਚ ਵਿੱਚੋਂ ਇੱਕ ਹੈ ਦੂਜਾ ਮੁੱਖ ਨਾਚ ਗਿੱਧਾ ਹੈ ਭੰਗੜਾ ਗੱਭਰੂਆਂ ਦਾ ਨਾਚ ਹੈ ਜਦਕਿ ਗਿੱਧਾ ਮੁਟਿਆਰਾਂ ਦਾ ਹੈ ਭੰਗੜਾ ਤਕਰੀਬਨ ਹਰ ਖੁਸ਼ੀ ਦੇ ਮੌਕੇ 'ਤੇ ਪਾਇਆ ਜਾਂ ਨੱਚਿਆ ਜਾਂਦਾ ਹੈ ਜਿਹਨਾਂ ਵਿੱਚ ਕਣਕ ਦੀ ਵਾਢੀ ਭਾਵ ਵਿਸਾਖੀ ਆਦਿ ਮੇਲੇ ਵਿਆਹ ਮੰਗਣੇ ਅਤੇ ਤਿਉਹਾਰ ਆਦਿ ਸ਼ਾਮਿਲ ਹਨ ਇਹ ਲੋਕ ਨਾਚ ਪੰਜਾਬ ਦੀ ਕਿਸਾਨੀ ਸ਼ਾਮਿਲ ਹਨ ਇਹ ਲੋਕ ਨਾਚ ਪੰਜਾਬ ਦੇ ਕਿਸਾਨੀ ਸੰਸਕ੍ਰਿਤਿਕ ਜਿਹਨਾਂ ਦੀ ਪ੍ਰਾਚੀਨ ਹੈ ਭੰਗੜਾ ਬਹੁਤ ਤਰ੍ਹਾਂ ਦਾ ਹੈ ਜਿਵੇਂ ਝੂਮਰ ਸੰਮੀ ਲੁੱਡੀ ਭੰਗੜਾ ਪੰਜਾਬੀਆਂ ਦਾ ਕੌਮੀ ਨਾਚ ਹੋਣ ਦਾ ਮਾਣ ਰੱਖਦਾ ਹੈ ਇਹ ਪੁਰਸ਼ਾਂ ਦਾ ਇੱਕੋ ਇੱਕ ਅਜਿਹਾ ਨਾਚ ਹੈ ਜਿਸ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਮੰਚਾਂ ਉੱਤੇ ਪੰਜਾਬ ਦੇ ਪੁਰਸ਼ਾਂ ਦੇ ਨਾਚ ਵਜੋਂ ਪ੍ਰਵਾਨ ਕੀਤਾ ਗਿਆ ਹੈ ਭੰਗੜੇ ਦੇ ਆਰੰਭ ਵਿੱਚ ਢੋਲੀ ਵਿਸ਼ੇਸ਼ ਕਿਸਮ ਦੇ ਤਾਲ ਨਾਲ ਭੰਗੜੇ ਵਾਲੇ ਗੱਭਰੂਆਂ ਨੂੰ ਸੱਦਾ ਦਿੰਦਾ ਹੈ ਬੋਲੀਆਂ ਬਿਨਾਂ ਭੰਗੜੇ ਅਧੂਰਾ ਸਮਝਿਆ ਜਾਂਦਾ ਹੈ ਭੰਗੜਾ ਪਹਿਲਾਂ ਪੱਛਮੀ ਪੰਜਾਬ ਦੇ ਜ਼ਿਲ੍ਹੇ ਸ਼ੇਖਪੁਰ ਪੱਛਮੀ ਗੁਜਰਾਤ ਅਤੇ ਸਿਆਲਕੋਟ ਵਿੱਚ ਜ਼ਿਆਦਾ ਪ੍ਰਚਲਿਤ ਹੈ ਭੰਗੜੇ ਵਿੱਚ ਪੇਂਡੂ ਸਾਜਾਂ ਦੀ ਹੀ ਵਰਤੋਂ ਕੀਤੀ ਜਾਂਦੀ ਹੈ ਇਸ ਵਿੱਚ ਢੋਲ ਭੰਗੜੇ ਅਤੇ ਮੁੱਖ ਸਾਜ਼ ਹਨ ਅਤੇ ਭੰਗੜੇ ਵਿੱਚ ਢੋਲੀ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ਭੰਗੜੇ ਗੱਭਰੂ ਮੁਟਿਆਰਾਂ ਬਲਕਿ ਸਭ ਦੀ ਜਾਨ ਹੁੰਦੀ ਹੈ ਪੰਜਾਬੀ ਸੱਭਿਆਚਾਰ ਵਿੱਚ ਭੰਗੜਾ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਵਿਆਹ ਸ਼ਾਦੀਆਂ ਦੇ ਮੌਕੇ 'ਤੇ ਇਹ ਹਮੇਸ਼ਾ ਪਾਇਆ ਜਾਂਦਾ ਹੈ ਸਾਡੇ ਨਾਲ ਸਾਡੇ ਘਰ ਵੀ ਵਿਆਹ ਵਿੱਚ ਧੂੰਮਧਾਮ ਨਾਲ ਭੰਗੜਾ ਪਾਇਆ ਗਿਆ ਹੈ ਭੰਗੜੇ ਦੀ ਸ਼ਾਨ ਵਧੇਰੇ ਹੁੰਦੀ ਹੈ ਭੰਗੜਾ ਖੁਸ਼ੀ ਦੇ ਮੌਕੇ 'ਤੇ ਪਾਇਆ ਜਾਂਦਾ ਹੈ ਭੰਗੜੇ ਵਿੱਚ ਕਈ ਤਰ੍ਹਾਂ ਦੇ ਸਾਜਾਂ ਹੁੰਦੀਆਂ ਹਨ ਗਿੱਧਾ ਹੁੰਦਾ ਝੁੰਮਰ ਹੁੰਦਾ ਇਹਨਾਂ ਨਾਲ ਭੰਗੜੇ ਦੀ ਸ਼ਾਨ ਵੱਧਦੀ ਹੈ ਭੰਗੜਾ ਹਮੇਸ਼ਾ ਮੁੰਡਿਆਂ ਅਤੇ ਕੁੜੀਆਂ ਦੇ ਵਿਚਕਾਰ ਪਾਇਆ ਜਾਂਦਾ ਹੈ ਗੱਭਰੂ ਸੱਜ ਧੱਜ ਕੇ ਕੈਂਠੇ ਪਾ ਕੇ ਭੰਗੜਾ ਪਾਉਂਦੇ ਭੰਗੜੇ ਵਿੱਚ ਆਉਂਦੇ ਹਨ ਕੁੜੀਆਂ ਵੀ ਭੰਗੜੇ ਵਿੱਚ ਭੰਗੜਾ ਪਾਉਂਦੀਆਂ